ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਹੋਰ ਸੁਣਾਓ ਕੀ ਹਾਲ ਜੇ ਸਰ ਮੈਂ ਦਿੱਲੀਓ ਨਾ ਘੁੰਮਣ ਆਇਆ ਅੰਮ੍ਰਿਤਸਰ ਅਤੇ ਮੈਨੂੰ ਫੋਨ ਤੁਹਾਡਾ ਕਿਸੇ ਯਾਰ ਦੋਸਤ ਨੇ ਦਿੱਤਾ ਸੀ ਤੁਹਾਡਾ ਨੰਬਰ ਕਹਿੰਦੇ ਕੋਈ ਪ੍ਰੋਬਲਮ ਆਈ ਕੋਈ ਗੱਲਬਾਤ ਪੁੱਛਣੀ ਹੋਏਗੀ ਉਹਨਾਂ ਨੂੰ ਪੁੱਛ ਲੈਣਾ ਅਤੇ ਮੈਨੂੰ ਦੱਸੋ ਕਿ ਮੈਨੂੰ ਇੱਥੇ ਖਾਣ ਦੀ ਪ੍ਰੋਬਲਮ ਆਣਡੀ ਖਾਣ ਦਾ ਕੋਈ ਚੰਗਾ ਜਿਹਾ ਢਾਬਾ ਰੈਸਟੋਰੈਂਟ ਨਹੀਂ ਕੋਈ ਨਜ਼ਰ ਆਇਆ ਕੋਈ ਉਹ ਦੱਸੋ ਕਿਹੜਾ ਹੈਗਾ ਅੰਮ੍ਰਿਤਸਰ ਦਰਬਾਰ ਸਾਹਿਬ ਘੁੰਮ ਲਿਆ ਮੈਂ ਸ਼ੀਤਲਾ ਮੰਦਰ ਘੁੰਮ ਆਇਆ ਤਾਂ ਤੁਸੀਂ ਦੱਸੋ ਢਾਬਾ ਰਾਤੀ ਰੋਟੀ ਖਾਣੀ ਆ ਹਮ ਕੇਸਰ ਦੇ ਢਾਬੇ ਦਾ ਬੜਾ ਨਾਂ ਸੁਣਿਆ ਕੇਸਰ ਦੇ ਢਾਬੇ ਦਾ ਨਾਮ ਬੜਾ ਸੁਣਿਆ ਉਹ ਕਿੱਥੇ ਆ ਹਮ

ਜੀ ਜੀ ਚਲੋ ਠੀਕ ਹੈ ਸਰ ਹਾਂਜੀ

ਚਲੋ ਫਿਰ ਸਵੇਰੇ ਵੇਖ ਲਾਂਗੇ ਉਹ ਵੀ ਟਰਾਈ ਕਰ ਲਾਂਗੇ ਅਤੇ ਚਲੋ ਹੁਣ ਮੈਂ ਜਰਾ ਗੱਡੀ ਪਾਰਕਿੰਗ ਕਰਨ ਲੱਗਾ ਥੋੜ੍ਹੀ ਜਲਦੀ 'ਚ ਹੈ ਅਤੇ ਫਿਰ ਤੁਹਾਡੇ ਨਾਲ ਗੱਲ ਕਰਾਂਗਾ ਜੇ ਲੋੜ ਪਈ ਅਤੇ ਫਿਰ ਤੁਹਾਡੇ ਨਾਲ ਗੱਲ ਜ਼ਰੂਰ ਕਰਾਂਗਾ ਰਾਬਤਾ ਕਾਇਮ ਕਰਾਂਗਾ ਅਤੇ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਸਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ